ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਹੈ ਇਸਨੂੰ ਗੁ ਇਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚਲਦੀ ਆ ਰਹੀ ਹੈ ਸਾਨੂੰ ਆਪਣੀ ਭਾਸ਼ਾ 'ਤੇ ਪੰਜਾਬੀ ਭਾਸ਼ਾ 'ਤੇ ਬਹੁਤ ਮਾਣ ਹੈ ਇਹ ਗੁ ਪੇ ਇਸਨੂੰ ਪਹਿਲਾਂ ਗੁਰਮੁਖੀ ਕਿਹਾ ਜਾਂਦਾ ਸੀ ਅਤੇ ਹੁਣ ਇਹ ੳ ਤੋਂ ੳ ਤੋਂ ਅ ਤੱਕ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਹੈ ਇਹ ਪੰਜਾਬੀਆਂ ਦੀ ਮਾਤ ਭਾਸ਼ਾ ਹੈ ਸ ਪੂਰੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸਮਿਆਂ ਤੋਂ ਚਲਦੀ ਆ ਰਹੀ ਹੈ ਜ਼ਿਆਦਾਤਰ ਲੋਕ ਪੰਜਾਬ ਪੰਜਾਬੀ ਓ ਹੀ ਬੋਲਦੇ ਹਨ ਇਹ ਫ਼ਾਰਸੀ ਫ਼ਾਰਸੀ ਫ਼ਾਰਸੀ ਫ਼ਾਰਸੀ ਭਾਸ਼ਾ ਤੋਂ ਬਣੀ ਫ਼ਾਰਸੀ ਵਿੱਚ ਇਸ ਨੂੰ ਫ਼ਾਰਸੀ ਵਿੱਚ ਵੰਡਿਆ ਗਿਆ ਹੈ ਪੰਜਾ ਪੰਜਾਬੀ ਭਾਸ਼ਾ ਸਾਡੇ ਪੂਰੇ ਪੰਜਾਬ ਵਿੱਚ ਬੋਲੀ ਜਾਂਦੀ